ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕਿਆ ਹਾਲ ਚਾਲ ਹੈ ਭਾਅ ਜੀ ਭਾਅ ਜੀ ਢਿੱਲੋਂ ਟਰੈਵਲ ਏਜੰਸੀ 'ਚੋਂ ਬੋਲਦੇ ਹੈਗੇ ਹੈ ਭਾਅ ਜੀ ਮੈਂ ਨਾ ਤੁਹਾਡੀ ਨਾ ਇੱਕ ਉਹ ਕੈਬ ਬੁੱਕ ਕੀਤੀ ਸੀਗੀ ਆਪਾਂ ਹਿਮਾਚਲ ਟੂਰ 'ਤੇ ਜਾਣਾ ਸੀਗਾ ਉਹਦੇ ਵਾਸਤੇ ਬੁੱਕ ਕੀਤੀ ਸੀਗੀ ਉਹਦੇ ਵਾਸਤੇ ਮੈਂ ਤੁਹਾਨੂੰ ਭਾਅ ਜੀ ਥੋੜ੍ਹੀ ਪੇਮੈਂਟ ਵੀ ਕੀਤੀ ਸੀਗੀ ਪੰਜ ਚਾਰ ਹਜ਼ਾਰ ਜੋ ਵੀ ਹੈਗੇ ਤੁਸੀਂ ਅਡਵਾਂਸ ਕਿਹਾ ਸੀਗਾ ਮੈਨੂੰ ਇਹ ਦੇਣ ਵਾਸਤੇ ਹੁਣ ਉਹ ਭਾਅ ਜੀ ਨਾ ਮੈਨੂੰ ਨਾ ਉਹਦਾ ਟੂਰ ਨਾ ਕੈਂਸਲ ਕਰਨਾ ਪੈਣਾ ਹੈਗਾ ਜਿੱਦਾਂ ਤੁਹਾਨੂੰ ਪਤਾ ਹੈ ਭਾਅ ਜੀ ਹੁਣ ਜਿੱਦਾਂ ਹੜ੍ਹਾਂ ਦਾ ਮਾਹੌਲ ਬਣ ਗਿਆ ਵਾ ਹੈਗਾ ਹੈ ਅਤੇ ਉਹਦੇ ਕਰਕੇ ਹਿਮਾਚਲ 'ਚ ਵੀ ਹੁਣ ਤੁਹਾਨੂੰ ਪਤਾ ਭਾਅ ਜੀ ਵੀ ਮਤਲਬ ਹਾਲਾਤ ਉੱਥੇ ਠੀਕ ਨਹੀਂ ਹੈਗੇ ਹੈ ਹੜ੍ਹ ਹੁੜ੍ਹ ਕਰਕੇ ਸੜਕਾਂ ਦਾ ਵੀ ਮਾੜਾ ਹਾਲ ਹੈ ਅਤੇ ਰਹਿਣ ਸਹਿਣ ਦਾ ਵੀ ਅਤੇ ਉੱਦਾਂ ਵੀ ਉੱਥੇ ਕਾਫੀ ਚੀਜ਼ਾਂ ਦੀ ਸੋਰਟੇਜ ਚੱਲਦੀ ਹੈਗੀ ਹੈ ਉਹਦੇ ਕਰਕੇ ਨਾ ਭਾਅ ਜੀ ਆਪਾਂ ਜਿੱਦਾਂ ਹੁਣ ਸਾਰੇ ਦੋਸਤ ਹੈਗੇ ਹੈ ਆਪਾਂ ਨੇ ਸਾਰਿਆਂ ਨੇ ਮਿਲ ਕੇ ਡਿਸੀਜਨ ਲਿਆ ਹੈਗਾ ਵੀ ਆਪਾਂ ਵੀ ਥੋੜ੍ਹਾ ਜਿਹਾ ਪਲੈਨ ਵੀ ਹੁਣ ਕੈਂਸਲ ਕਰ ਦੂਗੇ ਜਾਂ ਫਿਰ ਅਗਲੇ ਸਾਲ ਦੇਖਾਂਗੇ ਜਾਂ ਥੋੜ੍ਹੇ ਟਾਇਮ ਬਾਅਦ ਆਪਾਂ ਪਲੈਨਿੰਗ ਵਗੈਰਾ ਬਣਾਲਾਂਗੇ ਇਹਦੀ ਭਾਅ ਜੀ ਉਹਦੇ ਕਰਕੇ ਨਾ ਮੈਨੂੰ ਨਾ ਜਿੱਦਾਂ ਹੁਣ ਤੁਹਾਨੂੰ ਆਹ ਜਿਹੜੀ ਪੇਮੈਂਟ ਮਤਲਬ ਪੈਮੈਂਟ ਆਪਾਂ ਤੁਹਾਨੂੰ ਪਹਿਲੇ ਦਿੱਤੀ ਸੀਗੀ ਮੈਂ ਸਾਈ ਦਿੱਤੀ ਸੀਗੀ ਉਹ ਭਾਅ ਜੀ ਮੈਂ ਤੁਹਾਡੇ ਉਹ ਇਹੀ ਦਰਖਾਸਤ ਸੀ ਮੇਰੀ ਮੈਨੂੰ ਤੁਸੀਂ ਵਾਪਸ ਕਰ ਦੂਗੇ ਤੁਸੀਂ ਮੈਨੂੰ ਦਸ ਦਿਉ ਵੀ ਜਿੱਦਾਂ ਵੀ ਆਪਸ 'ਚ ਕਰਨੀ ਜੇ ਕੈਸ਼ ਕਰਨੀ ਤਾਂ ਮੈਂ ਤੁਹਾਡੇ ਕੋਲ਼ ਆ ਕੇ ਏਜੰਸੀ 'ਚੋਂ ਲੈ ਜੂਗਾ ਅਤੇ ਜਿੱਦਾਂ ਵੀ ਹੈਗਾ ਹੈ ਤਾਂ ਮੇਰੇ ਅਕਾਊਂ ਆਹ ਨੰਬਰ 'ਤੇ ਭਾਅ ਜੀ ਮੇਰਾ ਉਹ ਵੀ ਚੱਲਦਾ ਹੈਗਾ ਗੂਗਲ ਪੇ ਅਕਾਊਂਟ ਤੁਸੀ ਮੈਨੂੰ ਇਹਦੀ ਵਿੱਚ ਵੀ ਭਾਅ ਜੀ ਪਾ ਸਕਦੇ ਹੈ ਧੰਨਵਾਦ ਭਾਅ ਜੀ